ਗਾਉਣ ਦਾ ਸ਼ੌਂਕ ਤਾਂ ਮੈਨੂੰ ਛੋਟੇ ਹੁੰਦਿਆਂ ਤੋਂ ਹੀ ਸੀ ਬਚਪਨ ਤੋਂ ਹੀ ਮੈਂ ਗਾ ਰਿਹਾਂ ਮੈਂ ਚੌਥੀ ਤੋਂ ਪੰਜਵੀਂ ਕਲਾਸ ਤੋਂ ਗਾਉਣਾ ਸ਼ੁਰੂ ਕੀਤਾ ਸੀ ਜਦੋਂ ਉਦੋਂ ਜਦੋਂ ਛੋਟੇ ਹੁੰਦੇ ਸੀ ਚੌ ਚੌਥੀ ਤੋਂ ਪੰਜਵੀਂ ਕਲਾਸ 'ਚ ਉਦੋਂ ਸਕੂਲ ਦੇ ਵਿੱਚ ਹਰੇਕ ਸ ਸ਼ ਸ਼ਨੀਵਾਰ ਨੂੰ ਬਾਲ ਸਭਾ ਲੱਗਦੀ ਹੁੰਦੀ ਸੀ ਅਤੇ ਛੁੱਟੀ ਹੋਣ ਤੋਂ ਥੋੜ੍ਹਾ ਜਿਹਾ ਟਾਈਮ ਪਹਿਲਾਂ ਅਤੇ ਘੰਟਾ ਅੱਧਾ ਘੰਟਾ ਕੁ ਪਹਿਲਾਂ ਬਾਲ ਸਭਾ ਲੱਗਦੀ ਹੁੰਦੀ ਸੀ ਅਤੇ ਉਹਦੇ ਵਿੱਚ ਸਾਰੇ ਹੀ ਜਵਾਕ ਕੁਝ ਨਾ ਕੁਝ ਕੋਈ ਚੁਟਕਲੇ ਸੁਣਾਉਂਦਾ ਹੁੰਦਾ ਸੀ ਜਿਹਨੂੰ ਗਾਉਣਾ ਆਉਂਦਾ ਸੀ ਗਾ ਲੈਂਦਾ ਸੀ ਜਾਂ ਕੁਝ ਵੀ ਹੋਰ ਜਿਸ 'ਚ ਜਿਹੜੀ ਵੀ ਕਲਾ ਹੁੰਦੀ ਸੀ ਉਹ ਉੱਦਾਂ ਹੀ ਆਪਣਾ ਕਰਦਾ ਸੀ ਅਤੇ ਜਦੋਂ ਮੈਂ ਉਦੋਂ ਫਿਰ ਗਾਉਣ ਲੱਗਾ ਉਦੋਂ ਮੈਨੂੰ ਬਹੁਤ ਡਰ ਲੱਗਦਾ ਹੁੰਦਾ ਸੀ ਮੈਂ ਗਾਉਂਦਾ ਨਹੀਂ ਸੀ ਹੁੰਦਾ ਨਰਵਸ ਵੀ ਹੋ ਜਾਂਦਾ ਸੀ ਮੈਂ ਡਰਦਾ ਹੁੰਦਾ ਸੀ ਅਤੇ ਜਦੋਂ ਫਿਰ ਮੈਂ ਚੌਥੀ ਕਲਾਸ 'ਚ ਸੀ ਉਦੋਂ ਸ਼ਾਇਦ ਅਤੇ ਮੈਨੂੰ ਮੇਰੀ ਮੈਮ ਨੇ ਠਾਲਿਆ ਅਤੇ ਮੈਨੂੰ ਹੌਂਸਲਾ ਦਿੱਤਾ ਵੀ ਚੱਲ ਗਾ ਹੈ ਨਾ ਉਹਨੂੰ ਮੈਂ ਕਿਹਾ ਸੀ ਵੀ ਮੈਂ ਗਾ ਲੈਂਦਾ ਅਤੇ ਉਹਨਾਂ ਨੇ ਮੈਨੂੰ ਕਿਹਾ ਵੀ ਗਾ ਤੂੰ ਵੀ ਗਾ ਹੈ ਨਾ ਵੀ ਸਾਰੇ ਜਵਾਕ ਗਾਈ ਜਾਂਦੇ ਨੇ ਤੂੰ ਗਾਉਂਦਾ ਨਹੀਂ ਹੈ ਨਾ ਵੀ ਤੂੰ ਕਹਿੰਦਾ ਮੈਂ ਗਾ ਲੈਂਦਾ ਹੈ ਨਾ ਵੀ ਚੱਲ ਗਾ ਅਤੇ ਉਦੋਂ ਚਲੋ ਮੈਨੂੰ ਕ ਉੱਠ ਕੇ ਮੈਂ ਗਾਉਣ ਤਾਂ ਲੱਗ ਗਿਆ ਅਤੇ ਉਦੋਂ ਮੈਂ ਨਰਵਸ ਵੀ ਸੀ ਡਰ ਵੀ ਰਿਹਾ ਸੀ ਪਰ ਫਿਰ ਵੀ ਚਲੋ ਹੌਂਸਲਾ ਦਿੱਤਾ ਹੋਇਆ ਸੀ ਮੈਂ ਮੈਮ ਨੇ ਅਤੇ ਮੈਂ ਗਾਉਣ ਲੱਗ ਗਿਆ ਅਤੇ ਮੈਂ ਵਧੀਆ ਗਾਇਆ ਜਾਣੀ ਵਧੀਆ ਗਾ ਹੋ ਗਿਆ ਉਦੋਂ ਵੀ ਅਤੇ ਉਦੋਂ ਬਾਅਦ 'ਚ ਮੈਂ ਫਿਰ ਜਦੋਂ ਹੁਣ ਤੱਕ ਗਾਈ ਜਾਂਦਾ ਵਧੀਆ ਗਾ ਹੋ ਰਿਹਾ ਅਤੇ ਉਦੋਂ ਫਿਰ ਮੈਨੂੰ ਮੈਨੂੰ ਪਤਾ ਲੱਗ ਗਿਆ ਸੀ ਮੇਰੀ ਗਾਇਕੀ ਦੀ ਪ੍ਰ ਪ੍ਰਤਿਭਾ ਦਾ ਅਤੇ ਹੁਣ ਤੱਕ ਹੁਣ ਨਾ ਕਦੇ ਮੈਂ ਡਰਿਆ ਅਤੇ ਨਾ ਕਦੇ ਨਰਵਿਸ ਹੋਇਆ ਵਧੀਆ ਚੱਲੀ ਜਾਂਦਾ ਜਾਣੀ ਸਭ ਕੁਛ ਹੁਣ ਤੱਕ